ਸੰਗੀਤ ਅਤੇ ਨਾਚ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਹਨ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਲੋਕ ਆਪਣੇ ਮਨੋਰੰਜਨ ਦੇ ਲਈ ਸੰਗੀਤ ਅਤੇ ਡਾਂਸ ਦਾ ਸਹਾਰਾ ਲੈਂਦੇ ਆ ਰਹੇ ਹਨ ਡਾਂਸ ਇਹ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੈ ਜਿਸ ਦੇ ਵਿੱਚ ਇਨਸਾਨ ਆਪਣੀਆਂ ਸਾਰੀਆਂ ਟੈਨਸ਼ਨਾਂ ਤੋਂ ਮੁਕਤ ਹੋ ਜਾਂਦਾ ਹੈ ਉਸ ਨੂੰ ਇੱਕ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਉਹ ਇੱਕ ਅਲੱਗ ਹੀ ਦੁਨੀਆਂ ਦੇ ਵਿੱਚ ਮਸਤ ਹੋ ਜਾਂਦਾ ਹੈ ਡਾਂਸ ਦੀ ਪ੍ਰਕਿਰਿਆ ਦੇ ਵਿੱਚ ਜੋ ਵੀ ਇਨਸਾਨ ਹਿੱਸਾ ਲੈਂਦਾ ਹੈ ਉਸ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲ ਜਾਂਦਾ ਹੈ ਲਾਕਡਾਊਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਬੁਰੀਆਂ ਆਦਤਾਂ ਜੋ ਸੀ ਉਹ ਪੈਦਾ ਹੋਈਆਂ ਉਹਨਾਂ ਦੇ ਵਿੱਚ ਟੀਵੀ ਦੇ ਉੱਤੇ ਫਿਲਮਾਂ ਦੇਖਣਾ ਆਪਣਾ ਉਸ ਟਾਈਮ ਖਰਾਬ ਕਰਨਾ ਫੋਨ ਦੇਖਣਾ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਰਿਆਵਾਂ ਸੀ ਉਹਨਾਂ ਤੋਂ ਅਗਰ ਅਸੀਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਉਹਨਾਂ ਦੇ ਅੰਦਰ ਡਾਂਸ ਦੀ ਜਿਹੜੀ ਰੁਚੀ ਹੈ ਉਹ ਸਾਨੂੰ ਪੈਦਾ ਕਰਨੀ ਚਾਹੀਦੀ ਹੈ ਇਸ ਦੇ ਨਾਲ ਉਹਨਾਂ ਦੇ ਸਰੀਰ ਨੂੰ ਤੰਦਰੁਸਤੀ ਮਿਲੇਗੀ ਉਹਨਾਂ ਦੇ ਦਿਮਾਗ ਨੂੰ ਸ਼ਾਂਤੀ ਮਿਲੇਗੀ ਉਹਨਾਂ ਦੀਆਂ ਸ਼ਰੀਰਕ ਕਿਰਿਆਵਾਂ ਹੋਣਗੀਆਂ ਅਤੇ ਉਹਨਾਂ ਦੇ ਵਿੱਚ ਦੂਸਰੇ ਇਨਸਾਨਾਂ ਨਾਲ ਵਰਤਣ ਦੀ ਜੋ ਕਿਰਿਆ ਹੈ ਉਹਨਾਂ ਨਾਲ ਮਿਲਵਰਤਨ ਦੀ ਭਾਵਨਾ ਹੈ ਉਹ ਪੈਦਾ ਹੋਵੇਗੀ ਮੈਂ ਵੀ ਡਾਂਸ ਦੇ ਵਿੱਚ ਹਿੱਸਾ ਲੈਂਦੀ ਹਾਂ ਉਸ ਆਪਣੇ ਹੁਨਰ ਨੂੰ ਸੁਧਾਰਨ ਦੇ ਲਈ ਲਗਾਤਾਰ ਮੈਂ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਖਦੀ ਹਾਂ ਇਸ ਤਰ੍ਹਾਂ ਦੀਆਂ ਕਿਰਿਆਵਾਂ ਦੇਖਦੀ ਹਾਂ ਜਿਸ ਦੇ ਨਾਲ ਮੇਰੀ ਮਨ ਦੇ ਵਿੱਚ ਵੱਧ ਤੋਂ ਵੱਧ ਡਾਂਸ ਨੂੰ ਸਿੱਖਣ ਦੀ ਜੋ ਰੁਚੀ ਹੈ ਉਹ ਪੈਦਾ ਹੁੰਦੀ ਹੈ ਇਸ ਤਰ੍ਹਾਂ ਮੈਂ ਆਪਣੇ ਹੁਨਰ ਨੂੰ ਲਗਾਤਾਰ ਸੁਧਾਰਨ ਦੇ ਲਈ ਟੀਵੀ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਜੋ ਰਿਐਲਿਟੀ ਸ਼ੋ ਜਿਵੇਂ ਕਿ ਨੱਚ ਬੱਲੀਏ ਡਾਂਸ ਇੰਡੀਆ ਡਾਂਸ ਇਹਨਾਂ ਨੂੰ ਵੀ ਦੇਖਦੀ ਹਾਂ ਫੋਲੋ ਕਰਦੀ ਹਾਂ ਜਿਸ ਦੇ ਨਾਲ ਮੈਂ ਇਸ ਤੋਂ ਅਲੱਗ ਅਲੱਗ ਤਰ੍ਹਾਂ ਦੇ ਡਾਂਸ ਦੇ ਸਟੈਪ ਵੀ ਸਿੱਖਦੀ ਹਾਂ ਇਸ ਤਰੀਕੇ ਨਾਲ ਮੈਂ ਆਪਣੇ ਬੱਚਿਆਂ ਨੂੰ ਵੀ ਅੱਗੇ ਵਧਣ ਲਈ ਉਹਨਾਂ ਨੂੰ ਸਿੱਖਣ ਲਈ ਪ੍ਰੇਰਿਤ ਕਰਦੀ ਰਹਿੰਦੀ ਹਾਂ ਮੈਂ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਡਾਂਸ ਨੂੰ ਕਰਦੀ ਹਾਂ ਇਸ ਨਾਲ ਮੈਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਮਿਲਦੀ ਹੈ